ਮੇਰਾ ਇੱਕ ਮਨਪਸੰਦ ਟੀ ਵੀ ਸ਼ੋਅ ਹੈ ਜਿਸ ਦਾ ਨਾਮ ਕਪਿਲ ਸ਼ਰਮਾ ਸ਼ੋਅ ਹੈ ਇਹ ਇੱਕ ਕਾਮੇਡੀ ਸ਼ੋਅ ਹੈ ਜਿਸ ਵਿੱਚ ਕਿ ਬਹੁਤ ਤਰ੍ਹਾਂ ਦੇ ਪ੍ਰਸਿੱਧ ਗਾਇਕ ਆਰਟਿਸਟ ਜਾਂ ਹੋਰ ਐਕਟਰ ਆਉਂਦੇ ਹਨ ਅਤੇ ਉਹ ਆਪਣੇ ਫ਼ਿਲਮਾਂ ਜਾਂ ਗਾਣਿਆਂ ਦੀ ਪ੍ਰਮੋਸ਼ਨਾਂ ਵੀ ਕਰਦੇ ਹਨ ਇਸ ਵਿੱਚ ਜੋ ਕਿ ਹੋਸਟ ਕਪਿਲ ਹੈ ਉਹ ਲੋਕਾਂ ਨੂੰ ਹਸਾਉਂਦਾ ਹੈ ਅਤੇ ਜੋ ਵੀ ਉੱਥੇ ਆਰਟਿਸਟ ਮੌਜੂਦ ਹੁੰਦੇ ਹਨ ਉਹਨਾਂ ਤੋਂ ਪ੍ਰਸ਼ਨ ਕਰਦਾ ਹੈ ਅਤੇ ਉਹਨਾਂ ਦੀ ਜੋ ਕਿ ਲਾਈਫ਼ ਬਾਰੇ ਚੱਲਦਾ ਹੈ ਜਾਂ ਕੀ ਹੋ ਚੁੱਕਾ ਹੈ ਉਸ ਬਾਰੇ ਗੱਲਬਾਤ ਵੀ ਕਰਦਾ ਹੈ ਇਹ ਮੇਰਾ ਮਨਪਸੰਦ ਟੀ ਵੀ ਸ਼ੋਅ ਹੈ